ਤਿੰਨ ਅਗਸਤ ਉੱਨੀ ਸੌ ਸਤਾਨਵੇਂ ਵੀਹ ਨਵੰਬਰ ਉੱਨੀ ਸੌ ਸੱਤਰ ਅਤੇ ਦੋ ਅਕਤੂਬਰ ਦੋ ਹਜ਼ਾਰ ਪੰਦਰ੍ਹਾਂ ਪੰਜ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਅਤੇ ਵੀਹ ਸਤੰਬਰ ਦੋ ਹਜ਼ਾਰ ਇੱਕ